ਕਿਫਾਇਤੀ ਆਵਾਜਾਈ ਦੀ ਘਾਟ ਨੇ ਸਾਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਜੇ ਅੱਜ ਕੱਲ ਕਿਫਾਇਤੀ ਆਵਾਜਾਈ ਹੋਏ ਇਕਨੋਮੀਕਲ ਆਵਾਜਾਈ ਹੋਏ ਜਿਹਦੇ ਥਰੂ ਆਪਾਂ ਜੇ ਕਹੀਏ ਅਸੀਂ ਜਹਾਜ਼ 'ਤੇ ਮੁੰਬਈ ਜਾਣਾ ਚਾਹੁੰਦੇ ਹਾਂ ਮੈਂ ਕੋਈ ਡਾਕਟਰ ਦੀ ਸਲਾਹ ਲੈਣੀ ਹੈ ਤਾਂ ਮੈਂ ਕਹੂੰਗੀ ਮੈਂ ਜ ਮੁੰਬਈ ਜਾਣ ਲਈ ਮੈਨੂੰ ਜਹਾਜ਼ ਲੈਣਾ ਪਊਗਾ ਜਾਂ ਟ੍ਰੇਨ ਲੈਣੀ ਪਊਗੀ ਜਿਹਦੀ ਇੰਨੀ ਇੰਨੀ ਚਾਰਜ਼ਿਜ਼ ਹੈ ਹਰ ਕੋਈ ਬੰਦਾ ਉਹ ਅਫੋਰਡ ਨਹੀਂ ਕਰ ਸਕਦਾ ਤਾਂ ਹੀ ਅੱਜ ਕੱਲ ਪੜ੍ਹਨਾ ਨੌਕਰੀ ਕਰਨਾ ਸਿਹਤ ਸੰਭਾਲ ਕਰਨੀ ਸਿਰਫ ਵੱਡੇ ਲੋਕਾਂ ਦੇ ਹੀ ਕੰਮ ਰਹਿ ਗਏ ਹਨ ਕਿਉਂਕਿ ਉਹੀ ਬੰਦੇ ਅਫੋਰਡ ਕਰ ਸਕਦੇ ਹੈ ਉਹੀ ਬੰਦੇ ਨੇੜੇ ਦੂਰ ਜਾ ਕੇ ਆਪਦੇ ਅਗਰ ਟਰੀਟਮੈਂਟ ਕਰਵਾ ਸਕਦੇ ਜੇ ਸਾਡੇ ਵਰਗੇ ਲੋਕਾਂ ਦਾ ਦੇਖੇ ਜਿਹੜੇ ਛੋਟੇ ਸ਼ਹਿਰਾਂ 'ਚ ਬੈਠੇ ਨੇ ਉਹਨਾਂ ਨੂੰ ਅਗਰ ਕੋਈ ਟਰੀਟਮੈਂਟ ਕਰਵਾਉਣਾ ਹੈ ਤਾਂ ਉਹਨਾਂ ਨੂੰ ਦੂਰ ਜਾਣਾ ਪੈਂਦਾ ਹੈ ਜੇ ਉਹ ਨੇੜੇ ਕਿਤੇ ਟਰੀਟਮੈਂਟ ਕਰਵਾਉਣਗੇ ਤਾਂ ਹੋ ਸਕਦਾ ਉੱਥੇ ਓਨੇ ਚੰਗੇ ਐਕਸਪੀਰੀਅੰਸ ਡਾਕਟਰ ਨਾ ਹੋਣ ਜਾਂ ਓਨੀ ਚੰਗੀ ਸਲਾਹ ਨਾ ਦਿੱਤੀ ਜਾਵੇ ਜਾਂ ਓਨੀ ਚੰਗੀ ਸਿੱਖਿਆ ਨਾ ਹੋਵੇ ਜੇ ਦੇਖਿਆ ਜਾਵੇ ਤਾਂ ਨੌਕਰੀ ਵੀ ਹੋ ਸਕਦਾ ਕਿ ਓਨੀ ਵਧੀਆ ਨਾ ਮਿਲੇ ਤਾਂ ਉਹ ਫਿਰ ਬੰਦਾ ਰਿਸਟਰਿਕਟ ਹੋ ਕੇ ਰਹਿ ਜਾਂਦਾ ਕਿ ਉਹਨੂੰ ਇੱਥੇ ਹੀ ਕੰਮ ਕਰਨਾ ਹੈ ਉਹਨੂੰ ਇੱਥੇ ਹੀ ਪੜ੍ਹਾਈ ਕਰਨੀ ਹੈ ਹੋ ਸਕਦਾ ਉਹ ਬੰਦਾ ਇੰਨਾ ਯੋਗ ਯੋਗ ਯੋਗੀ ਹੋਵੇ ਕਿ ਉਹ ਬਾਹਰ ਜਾ ਕੇ ਵਧੀਆ ਕੰਮ ਕਰ ਸਕਦਾ ਹੈ ਜਾਂ ਬਾਹਰ ਜਾ ਕੇ ਜ਼ਿਆਦਾ ਪੈਸੇ ਕਮਾ ਸਕਦਾ ਹੈ ਪਰ ਫਿਰ ਅਗਲਾ ਬੰਦਾ ਕਹਿੰਦਾ ਮੇਰਾ ਪਰਿਵਾਰ ਇੱਥੇ ਹੈ ਤਾਂ ਮੈਂ ਕਿਵੇਂ ਜਾਊਂਗਾ ਉੱਥੇ ਤਾਂ ਮੈਨੂੰ ਹਰ ਟਾਈਮ ਇੰਨਾ ਪੈਸਾ ਖਰਚ ਕਰਨਾ ਪਊਗਾ ਜਿੰਨਾ ਮੈਨੂੰ ਪੈਸਾ ਮਿਲੇਗਾ ਓਨਾ ਤਾਂ ਆਏ ਜਾਏ 'ਤੇ ਹੀ ਖਰਚ ਹੋ ਜੇਗਾ ਤਾਂ ਕਿਫਾਇਤੀ ਆਵਾਜਾਈ ਦੀ ਘਾਟ ਨੇ ਸਾਡੇ ਨੇ ਸਾਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਹੈ ਥੈਂਕ ਯੂ